ਯਾਰ ਜੇ ਮੈਂ ਬਰਾੜ ਰੈਸਟੋਰੈਂਟ ਦੀ ਗੱਲ ਕਰਾਂ ਤਾਂ ਬਰਾੜ ਰੈਸਟੋਰੈਂਟ ਸਾਡੇ ਇਲਾਕੇ ਦਾ ਸਭ ਤੋਂ ਵਧੀਆ ਰੈਸਟੋਰੈਂਟ ਹੈ ਅਸੀਂ ਜਦੋਂ ਵੀ ਖਾਣਾ ਔਡਰ ਕਰਨਾ ਹੁੰਦਾ ਤਾਂ ਹਮੇਸ਼ਾ ਬਰਾੜ ਰੈਸਟੋਰੈਂਟ ਵਾਲਿਆਂ ਤੋਂ ਹੀ ਔਡਰ ਕਰਦੇ ਹਾਂ ਇੱਕ ਵਾਰ ਅਸੀਂ ਇਹਨਾਂ ਤੋਂ ਚੌਲ ਪਨੀਰ ਦੀ ਸਬਜ਼ੀ ਅਤੇ ਚਾਰ ਰੋਟੀਆਂ ਔਡਰ ਕੀਤੀਆਂ ਸੀ ਜਦੋਂ ਅਸੀਂ ਔਡਰ ਕੀਤਾ ਤਾਂ ਵੀਹ ਮਿੰਟਾਂ ਦੇ ਵਿੱਚ ਇਹਨਾਂ ਨੇ ਸਾਨੂੰ ਸਾਡਾ ਔਡਰ ਤਿਆਰ ਕਰਕੇ ਦੇ ਦਿੱਤਾ ਅਤੇ ਜੇ ਮੈਂ ਸਬਜ਼ੀ ਦੀ ਗੱਲ ਕਰਾਂ ਤਾਂ ਸਬਜ਼ੀ ਕਈ ਤਰ੍ਹਾਂ ਦੇ ਮਸਾਲੇ ਪਾ ਕੇ ਬਣਾਈ ਹੋਈ ਸੀ ਜਿਹਦੇ ਕਰਕੇ ਸਬਜ਼ੀ ਦਾ ਸੁਆਦ ਬਹੁਤ ਹੀ ਜ਼ਿਆਦਾ ਵਧੀਆ ਸੀ ਅਤੇ ਜੇ ਚੌਲਾਂ ਦੀ ਗੱਲ ਕੀਤੀ ਜਾਵੇ ਤਾਂ ਚੌਲ ਬਾਸਮਤੀ ਚੌਲ ਸੀ ਅਤੇ ਬਹੁਤ ਹੀ ਜ਼ਿਆਦਾ ਵਧੀਆ ਚੌਲ ਸੀ ਅਤੇ ਇਹਨਾਂ ਨੇ ਸਾਨੂੰ ਫ੍ਰੀ ਦੇ ਵਿੱਚ ਆਈਸਕ੍ਰੀਮ ਵੀ ਦਿੱਤੀ ਅਤੇ ਜਦੋਂ ਅਸੀਂ ਖਾਣਾ ਖਾਦਾ ਤਾਂ ਸਾਨੂੰ ਪੂਰੀ ਤਰ੍ਹਾਂ ਸੰਤੁਸ਼ਟੀ ਹੋ ਗਈ ਅਤੇ ਹੁਣ ਅਸੀਂ ਜਦੋਂ ਵੀ ਖਾਣਾ ਔਡਰ ਕਰਨਾ ਹੁੰਦਾ ਹੈ ਤਾਂ ਅਸੀਂ ਹਮੇਸ਼ਾ ਬਰਾੜ ਰੈਸਟੋਰੈਂਟ ਵਾਲਿਆਂ ਤੋਂ ਹੀ ਖਾਣਾ ਔਡਰ ਕਰਦੇ ਹਾਂ ਕਿਉਂਕਿ ਇਹਨਾਂ ਦਾ ਰੇਟ ਵੀ ਬਹੁਤ ਜ਼ਿਆਦਾ ਵਧੀਆ ਹੈ ਅਤੇ ਪਹਿਲੀ ਵਾਰ ਸਾਨੂੰ ਡਿਲੀਵਰੀ ਕਰਨ 'ਤੇ ਇਹਨਾਂ ਨੇ ਸਾਨੂੰ ਪੰਜਾਹ ਪਰਸੈਂਟ ਤੱਕ ਦਾ ਡਿਸਕਾਊਟ ਵੀ ਦਿੱਤਾ ਅਤੇ ਹੁਣ ਅਸੀਂ ਜਦੋਂ ਵੀ ਖਾਣਾ ਔਡਰ ਕਰਦੇ ਹਾਂ ਤਾਂ ਹਮੇਸ਼ਾ ਬਰਾੜ ਰੈਸਟੋਰੈਂਟ ਵਾਲਿਆਂ ਤੋਂ ਹੀ ਔਡਰ ਕਰਦੇ ਹਾਂ